ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਜਿੱਦਾਂ ਕਿ ਮੈਂ ਅੰਮ੍ਰਿਤਸਰ ਦਾ ਰਹਿਣ ਦਾ ਰਹਿਣ ਵਾਲਾ ਵਾਂ ਅਤੇ ਮੇਰੇ ਅੰਮ੍ਰਿਤਸਰ ਸ਼ਹਿਰ ਵਿੱਚ ਕਈ ਬਹੁਤ ਵੱਡੇ ਵੱਡੇ ਮਸ਼ਹੂਰ ਕਾਲਜ ਹਨ ਜਿਵੇਂ ਕਿ ਇੱਕ ਪੋਲੀਟੈਕਨੀਕਲ ਕਾਲਜ ਹੈ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਾਲਜ ਹੈ ਅਤੇ ਹੋਰ ਵੀ ਕਈ ਕਾਲਜ ਹੈ ਜਿਵੇਂ ਕਿ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਖਾਲਸਾ ਕਾਲਜ ਹੈ ਜੋ ਕਿ ਬਹੁਤ ਮਸ਼ਹੂਰ ਹਨ ਡੀ ਏ ਵੀ ਕੋਲਜ ਹੈ ਅੰਮ੍ਰਿਤਸਰ ਗਰੁੱਪ ਆਫ ਕਾਲਜ ਹੈ ਐਸੇ ਬਹੁਤ ਹੀ ਮਸ਼ਹੂਰ ਮਸ਼ਹੂਰ ਕਾਲਜ ਕਈ ਤਰ੍ਹਾਂ ਦੇ ਅੰਮ੍ਰਿਤਸਰ ਵਿੱਚ ਸਥਿਤ ਹਨ ਅਤੇ ਜਿੱਥੇ ਕਿ ਕਈ ਬੱਚੇ ਪੜ੍ਹਦੇ ਹਨ ਅਤੇ ਪ ਆਪਣਾ ਭਵਿੱਖ ਸੁਧਾਰਦੇ ਹਨ ਜੋ ਕਿ ਹਰ ਇਨਸਾਨ ਲਈ ਹਰ ਬੱਚੇ ਲਈ ਪੜ੍ਹਨਾ ਤਾਂ ਬਹੁਤ ਜ਼ਰੂਰੀ ਹੈ ਅਤੇ ਜੇ ਉਹਨਾਂ ਨੂੰ ਐਸਾ ਵਧੀਆ ਕਾਲਜ ਜਾਂ ਪਲੇਟਫਾਰਮ ਮਿਲ ਜੇ ਜਿੱਥੋਂ ਵਧੀਆ ਪੜ੍ਹ ਸਕਣ ਅਤੇ ਉਹਨਾਂ ਦੀ ਜ਼ਿੰਦਗੀ ਬਣ ਜਾਵੇਗੀ ਅਤੇ ਐਸੇ ਹੀ ਕਾ ਇਹਨਾਂ ਦੇ ਇਹੋ ਜਿਹੇ ਕਾਲਜਾਂ ਵਿੱਚ ਮੈਂ ਮੈਂ ਖੁਦ ਪੜ੍ਹ ਰਿਹਾ ਹਾਂ ਮੇਰੀਆਂ ਦੋਵੇਂ ਭੈਣਾਂ ਇੱਥੇ ਕਾਲਜ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਾਲਜ ਵਿੱਚ ਪੜ੍ਹੇ ਹਨ ਜਿਹੜਾ ਕਿ ਬਹੁਤ ਵਧੀਆ ਕਾਲਜ ਹੈ ਇੱਥੇ ਹਰ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਹਾਂ ਮੇਰੀਆਂ ਭੈਣਾਂ ਨੇ ਵੀ ਇੱਥੋਂ ਇੰਜਨੀਅਰਿੰਗ ਕੀਤੀ ਹੈ ਮੇਰਾ ਇੱਕ ਕਜਨ ਖਾਲਸਾ ਕਾਲਜ ਵਿੱਚ ਪੜ੍ਹ ਰਿਹਾ ਹੈ ਜਿੱਥੋਂ ਦੀ ਪੜ੍ਹਾਈ ਬਹੁਤ ਵਧੀਆ ਹੈ ਅਤੇ ਮੇਰੀ ਇੱਕ ਕਜਨ ਸਿਸਟਰ ਸੀ ਜਿਹਨੇ ਖਾ ਡੀ ਏ ਵੀ ਕਾਲਜ ਤੋਂ ਪੜ੍ਹਾਈ ਖਤਮ ਕੀਤੀ ਸੀ ਅਤੇ ਉਹਨੇ ਉੱਥੋਂ ਪੜ੍ਹ ਕੇ ਅੱਜ ਉਹ ਬਹੁਤ ਵਧੀਆ ਨੌਕਰੀ 'ਤੇ ਲੱਗ ਗਈ ਹੈ ਜਿਹੜਾ ਕਿ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਬਹੁਤ ਵਧੀਆ ਹੈ ਅਤੇ ਉਹ ਇਸ ਤਰ੍ਹਾਂ ਦੇ ਕਈ ਕਾਲਜ ਹਨ ਜਿੱਥੋਂ ਬੱਚੇ ਪੜ੍ਹ ਕੇ ਆਪਣਾ ਜ਼ਿੰਦਗੀ ਆਪਣਾ ਭਵਿੱਖ ਬਣਾਉਂਦੇ ਹਨ ਜਿਹੜਾ ਕਿ ਹਰ ਬੱਚੇ ਲਈ ਲਾਜ਼ਮੀ ਹੈ ਸਾਨੂੰ ਜ਼ਰੂਰ ਐਸੇ ਕਈ ਵਧੀਆ ਕਾਲਜ ਵਿੱਚ ਐਡਮਿਸ਼ਨ ਲੈ ਕੇ ਆਪਣਾ ਭਵਿੱਖ ਸੁਧਾਰਨਾ ਚਾਹੀਦਾ ਹੈ ਅਤੇ ਹਰ ਬੱਚੇ ਨੂੰ ਸੁਧਾਰਨਾ ਚਾਹੀਦਾ ਹੈ ਇਸ ਤ ਇਸ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਕਾਲਜ ਹਨ ਜਿਹੜੇ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹਨ ਅਤੇ ਬੱਚੇ ਕਾਫੀ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਉੱਥੇ ਪੜ੍ਹਦੇ ਹਨ ਅਤੇ ਆਪਣਾ ਭਵਿੱਖ ਸੁਧਾਰਦੇ ਹਨ ਧੰਨਵਾਦ